ਸਕੂਲਾਂ ਵਿੱਚ ਬਹੁਤ ਹੀ ਗਤੀਵਿਧੀਆਂ ਹੁੰਦੀਆਂ ਹਨ ਮੈਂ ਗਤੀਵਿਧੀਆਂ ਦੇ ਦੌਰਾਨ ਦੌੜਾਂ ਵਿੱਚ ਹਿੱਸਾ ਲਿਆ ਮੈਂ ਸਾਰਿਆਂ ਨਾਲ਼ੋਂ ਦੌੜ ਵਿੱਚ ਅੱਗੇ ਹੁੰਦੀ ਸੀ ਮੈਨੂੰ ਦੌੜਨਾ ਬਹੁਤ ਹੀ ਪਸੰਦ ਹੈ ਇਸ ਦੇ ਨਾਲ ਨਾਲ ਮੈਂ ਬੈਡਮੈਂਟਨ ਵਿੱਚ ਵੀ ਭਾਗ ਲਿਆ ਇਸ ਵਿੱਚ ਮੈਨੂੰ ਜਦੋਂ ਮੇਰੀ ਜਿੱਤ ਹੋਈ ਤਾਂ ਮੈਨੂੰ ਸੈਕਿੰਡ ਪ੍ਰਾਇਜ਼ ਮਿਲਿਆ ਇਹ ਪ੍ਰਾਇਜ਼ ਮੈਨੂੰ ਬਹੁਤ ਹੀ ਪਸੰਦ ਆਇਆ ਇਸ ਦੇ ਲਾ ਇਲਾਵਾ ਮੈਂ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਰਹੀ